ਅਸੀਂ ਮੌਜੂਦਾ ਪੌਦਿਆਂ ਤੋਂ ਹੋਰ ਪੌਦੇ ਤਿਆਰ ਕਰਨ ਲਈ ਹੋਰ ਵੀ ਕਾਫੀ ਤਕਨੀਕਾਂ ਵਰਤ ਸਕਦੇ ਹਾਂ ਜਿਵੇਂ ਕਿ ਮੈਨੂੰ ਛੋਟੇ ਹੁੰਦੇ ਹੀ ਘਰ ਵਿੱਚ ਪੌਦੇ ਲਾਉਣ ਦਾ ਬਹੁਤ ਸ਼ੌਂਕ ਸੀ ਅਤੇ ਮੈਂ ਕਾਫੀ ਪੌਦੇ ਲਾਉਂਦਾ ਹੁੰਦਾ ਸੀ ਅਸੀਂ ਕਿਆਰੀਆਂ ਵਿੱਚ ਸਬਜ਼ੀਆਂ ਵਗੈਰਾ ਜਾਂ ਹੋਰ ਕਾਫੀ ਪਲਾਂਟਸ ਵਗੈਰਾ ਲਾਉਂਦੇ ਰਹਿੰਦੇ ਸੀਗੇ ਘਰ ਵਿੱਚ ਜਦੋਂ ਅਸੀਂ ਪੌਦੇ ਲਾਉਂਦੇ ਸੀ ਅਤੇ ਕਿਆਰੀਆਂ ਬਣਾ ਕੇ ਅਤੇ ਅਸੀਂ ਪੌਦੇ ਲਾਉਣੇ ਸ਼ੁਰੂ ਕਰ ਦਿੰਦੇ ਸੀ ਅਤੇ ਉਹਨਾਂ ਨੂੰ ਹਰ ਰੋਜ਼ ਪਾਣੀ ਵਗੈਰਾ ਦਿੰਦੇ ਰਹਿੰਦੇ ਸੀ ਕਈ ਵਾਰ ਪੌਦੇ ਮੱਚ ਜਾਂਦੇ ਸੀ ਅਤੇ ਫਿਰ ਸਾਨੂੰ ਬਜ਼ਾਰੋਂ ਨਵੇਂ ਲੈ ਕੇ ਆਉਣੇ ਪੈਂਦੇ ਸੀਗੇ ਜਿਵੇਂ ਟਮਾਟਰ ਵਗੈਰਾ ਦੇ ਅਤੇ ਸਬਜ਼ੀਆਂ ਵਾਲੇ ਪੌ ਪੌਦੇ ਹੁੰਦੇ ਸੀਗੇ ਅਤੇ ਫਿਰ ਇ ਇੱਕ ਵਾਰੀ ਸਾਡੇ ਘਰਦਿਆਂ ਨੇ ਕਿਹਾ ਕਿ ਇਹ ਪੌਦੇ ਨਵੇਂ ਲਿਆਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਜਿਹੜੇ ਕੁਛ ਪੌਦੇ ਇੱਦਾਂ ਦੇ ਹੁੰਦੇ ਹਨ ਅਤੇ ਜੋ ਕਿ ਇਹਨਾਂ ਦੇ ਇਹਨਾਂ ਤੋਂ ਪੌਦਿਆਂ ਤੋਂ ਹੀ ਤਿਆਰ ਹੋ ਜਾਂਦੇ ਹਨ ਜਿਵੇਂ ਕਿ ਗੁਲਾਬ ਦੇ ਫੁੱਲ ਹੈ ਗੁਲਾਬ ਦੇ ਫੁੱਲ ਹੈ ਜੋ ਕਿ ਕ ਇਹ ਗੁਲਾਬ ਦੀਆਂ ਕਲਮਾਂ ਤੋਂ ਹੀ ਤਿਆਰ ਹੋ ਜਾਂਦੇ ਹਨ ਉਹਨਾਂ ਦੀਆਂ ਕਲਮਾਂ ਹੀ ਲੱਗ ਜਾਂਦੀਆਂ ਹਨ ਜਿਵੇਂ ਗਵਾਰਾ ਹੋ ਗਿਆ ਇਹਨਾਂ ਗਵਾਰੇ ਦੀਆਂ ਵੀ ਆਪਾਂ ਫਲੀਆਂ ਤੋਂ ਤਿਆਰ ਹੋ ਜਾਂਦਾ ਹੈ ਗਵਾਰਾ ਜਿਵੇਂ ਟਮਾਟਰ ਵਗੈਰਾ ਇਹਨਾਂ ਦੇ ਜਦੋਂ ਇਹ ਬੂਟੇ ਸੁੱਕ ਜਾਂਦੇ ਹਨ ਇਹਨਾਂ ਦੇ ਜੋ ਬੀਜ ਹੁੰਦੇ ਹਨ ਉਹ ਬੀਜ ਕੇ ਆਪਾਂ ਇਹਨਾਂ ਤੋਂ ਦੁਬਾਰਾ ਪੌਦੇ ਉਗਾ ਸਕਦੇ ਹਾਂ ਧੰਨਵਾਦ ਜੀ